ਅਠਾਈ ਮਈ ਦੋ ਹਜ਼ਾਰ ਪੰਜ ਗਿਆਰ੍ਹਾਂ ਅਗਸਤ ਦੋ ਹਜ਼ਾਰ ਪੰਜ ਬਾਈ ਜੁਲਾਈ ਦੋ ਹਜ਼ਾਰ ਗਿਆਰ੍ਹਾਂ ਦੋ ਅਪ੍ਰੈਲ ਉੱਨੀ ਸੌ ਨੜ੍ਹਿਨਵੇਂ ਤਿੰਨ ਮਾਰਚ ਉੱਨੀ ਸੌ ਅੱਸੀ